ਸਾਡੇ ਪਿੰਡ ਵਿੱਚ ਨਗਰ ਜੋਗੇ ਦੇ ਵਿੱਚ ਮਾਨਸਿਕ ਸਿਹਤ ਅਤੇ ਸਮੁੱਚੀ ਤੰਦਰੁਸਤੀ ਬਾਰੇ ਪਿੰਡ ਵੱਲੋਂ ਕੈਂਪ ਲਗਵਾਏ ਜਾਂਦੇ ਹਨ ਜਿਸ ਦੇ ਵਿੱਚ ਬੱਚੇ ਅਤੇ ਬੱਚੀਆਂ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ ਇਸ ਨਾਲ ਬੱਚਿਆਂ ਦੀ ਤੰਦਰੁਸਤੀ ਅਤੇ ਸਿਹਤ ਦਾ ਵਿਕਾਸ ਹੁੰਦਾ ਹੈ ਬੱਚਿਆਂ ਨੂੰ ਉਵੇਂ ਨਸ਼ੇ ਵਗੈਰਾ ਜੋ ਵੀ ਮਤਲਬ ਅੱਜ ਕੱਲ੍ਹ ਮੈਡੀਕਲ ਜਾਂ ਜੋ ਵੀ ਮਤਲਬ ਅੱਜ ਕੱਲ੍ਹ ਨਸ਼ੇ ਚੱਲ ਰਹੇ ਹਨ ਗੇਮਾਂ ਦੇ ਨਾਲ ਬੱਚਿਆਂ ਨੂੰ ਮਤਲਬ ਜਿਹੜਾ ਉਹਨਾਂ ਦਾ ਵਿਕਾਸ ਹੁੰਦਾ ਹੈ ਨਸ਼ਿਆਂ ਤੋਂ ਬੱਚੇ ਦੂਰ ਰਹਿੰਦੇ ਹਨ ਇੱਕ ਦੂਜੇ ਨਾਲ ਰਲ ਮਿਲ ਕੇ ਖੇਡਦੇ ਹਨ ਸਾਡੀ ਸਮੁੱਚੀ ਪੰਚਾਇਤ ਅਤੇ ਕਲੱਬ ਜਿਹੜੇ ਜੋ ਵੀ ਮਤਲਬ ਇੱਥੇ ਸਾਡੇ ਕਲੱਬ ਨੇ ਵੱਖ ਵੱਖ ਤਰ੍ਹਾਂ ਦੇ ਕਲੱਬ ਨੇ ਕੁਝ ਟੂਰਨਾਮੈਂਟ ਕਰਵਾਉਂਦੇ ਰਹਿੰਦੇ ਹਨ ਜਿਸ ਦੇ ਨਾਲ ਬੱਚੇ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਹਨ ਇੱਥੋਂ ਸਾਡੇ ਬੱਚੇ ਖੇਡ ਕੇ ਵਧੀਆ ਮਤਲਬ ਅੱਛੀਆਂ ਪਦਵੀਆਂ 'ਤੇ ਪਹੁੰਚ ਕੇ ਕੁਛ ਉਸ ਸਕੂਲ ਦੇ ਵਿੱਚ ਬੱਚੇ ਜਿਹੜੇ ਖੇਡੇ ਨੇ ਉਸ ਸਕੂਲ ਦੇ ਵਿੱਚ ਵੀ ਕੁਛ ਬੱਚੇ ਜੋਬ ਕਰ ਰਹੇ ਨੇ ਕੁਛ ਹੋਰ ਮਤਲਬ ਵੀ ਆਪਣਾ ਉੱਪਰੋਂ ਕਿਸੇ ਹੋਰ ਅੱਛੀ ਪੋਸਟ 'ਤੇ ਬੱਚੇ ਚਲੇ ਗਏ ਬੱਚਿਆਂ ਦਾ ਮਤਲਬ ਜਿਹੜਾ ਇਹ ਬਹੁਤ ਵਧੀਆ ਉਪਰਾਲਾ ਹੈ ਅੱਗੇ ਤੋੋਂ ਵੀ ਮੈਂ ਇੱਦਾਂ ਹੀ ਕਹੂੰ ਵੀ ਅੱਗੇ ਤੋਂ ਵੀ ਇੱਦਾਂ ਹੀ ਚੱਲਦਾ ਰਹੇ ਠੀਕ ਹੈ ਜੀ ਲਾਸਟ 'ਚ ਮੇਰਾ ਧੰਨਵਾਦ